ਵੈਸੇ ਤਾਂ ਇਹ ਜ ਮੇਰਾ ਜ਼ਿਆਦਾ ਸਮਾਂ ਡਿਊਟੀ ਉੱਤੇ ਹੀ ਲੰਘਦਾ ਹੈ ਪਰ ਜਦੋਂ ਮੈਂ ਵਿਹਲਾ ਹੁੰਦਾ ਹਾਂ ਉਸ ਦੌਰਾਨ ਮੈਂ ਘਰ ਰਹਿ ਕੇ ਪੜ੍ਹਦਾ ਹਾਂ ਅਤੇ ਟੀ ਵੀ ਦੇਖ ਲੈਂਦਾ ਹਾਂ ਮੋਬਾਈਲ ਚਲਾ ਲੈਂਦਾ ਹਾਂ ਅਤੇ ਕਈ ਵਾਰ ਖੇਡਣ ਚਲਾ ਜਾਂਦਾ ਹਾਂ